ਪੰਜਾਬ ਦਾ ਮੁੱਖ ਸੰਗੀਤ ਹੈ ਢੋਲ ਢੋਲ ਦੀਆਂ ਧੁਨਾਂ ਜਿੱਥੇ ਸ਼ੁਰੂ ਹੋਣ ਢੋਲ ਦਾ ਡਗਾ ਜਿੱਥੇ ਵੱਜਣਾ ਸ਼ੁਰੂ ਹੋਵੇ ਉੱਥੇ ਪੰਜਾਬੀਆਂ ਦੇ ਪੈਰ ਥਿਰਕਣ ਲੱਗ ਜਾਂਦੇ ਨੇ ਪੰਜਾਬੀ ਆਪਣੇ ਆਪ ਨੂੰ ਰੋਕ ਹੀ ਨਹੀਂ ਸਕਦੇ ਜੇ ਅਸੀਂ ਨ੍ਰਿਤ ਦੀ ਗੱਲ ਕਰੀਏ ਤਾਂ ਨ੍ਰਿਤ ਦੇ ਵਿੱਚ ਮੁੱਖ ਤੌਰ 'ਤੇ ਭੰਗੜਾ ਗਿੱਧਾ ਮਲਵਈ ਗਿੱਧਾ ਲੁੱਡੀ ਸੰਮੀ ਝੁੰਮਰ ਆਦਿ ਇਹ ਚੀਜ਼ਾਂ ਆਉਂਦੀਆਂ ਹਨ ਜੇ ਪੰਜਾਬ ਵਿੱਚ ਸਭ ਤੋਂ ਵੱਧ ਦਰਸ਼ਕਾਂ ਦਾ ਮਨ ਮੋਹਣ ਵਾਲੀ ਗੱਲ ਕਰੀਏ ਤਾਂ ਸਭ ਤੋਂ ਵੱਧ ਮਨ ਮੋਹਣ ਵਾਲੀ ਚੀਜ਼ ਹੈ ਗਿੱਧਾ ਅਤੇ ਭੰਗੜਾ ਪੰਜਾਬੀ ਗਿੱਧੇ ਅਤੇ ਭੰਗੜੇ ਨੂੰ ਲੈ ਕੇ ਬਹੁਤ ਖੁਸ਼ ਹੁੰਦੇ ਹਨ ਹਰ ਫੰਕਸ਼ਨ 'ਤੇ ਚਾਅ 'ਤੇ ਲੋਹੜੀ 'ਤੇ ਕੋਈ ਤਿਉਹਾਰ 'ਤੇ ਉਹਨਾਂ ਨੂੰ ਬਸ ਮੌਕਾ ਚਾਹੀਦਾ ਹੁੰਦਾ ਹੈ ਢੋਲ ਦਾ ਢੋਲ ਵਜਾਉਣ ਦਾ ਅਤੇ ਨੱਚਣ ਦਾ ਵੈਸੇ ਹੀ ਸਾਰੇ ਜਾਣਦੇ ਹਨ ਕਿ ਪੰਜਾਬੀ ਨੱਚਣ ਗਾਉਣ ਦੇ ਬਹੁਤ ਸ਼ੌਕੀਨ ਹੁੰਦੇ ਹਨ ਹਨ ਅਤੇ ਢੋਲ ਦੀਆਂ ਧੁਨਾਂ ਭੰਗੜੇ ਦੀਆਂ ਖਣਕਾਂ ਗਿੱਧੇ ਦੀਆਂ ਬੋਲੀਆਂ ਰੌਣਕਾਂ ਦਾ ਤਿਉਹਾਰ ਇਹ ਪੰਜਾਬ ਦੀ ਮੁੱਖ ਪਹਿਚਾਣ ਹੈ ਇਸ ਲਈ ਭੰਗੜਾ ਅਤੇ ਗਿੱਧਾ ਮੁੱਖ ਤੌਰ 'ਤੇ ਪੰਜਾਬ ਦੇ ਜਿਹੜੇ ਹੈਗੇ ਨੇ ਉਹ ਪ੍ਰਸਿੱਧ ਨ੍ਰਿੱਤ ਨੇ ਅਤੇ ਢੋਲ ਪੰਜਾਬ ਦਾ ਪ੍ਰਸਿੱਧ ਅਤੇ ਪ੍ਰਮੁੱਖ ਸੰਗੀਤ ਹੈ